ਪੰਜਾਬ ਵਿੱਚ ਕਈ ਤਰ੍ਹਾਂ ਦੇ ਵੱਡੇ ਵੱਡੇ ਮੂਵੀ ਥੀਏਟਰ ਜਾਂ ਮਲਟੀਪਲੈਕਸ ਹਨ ਜੋ ਕਿ ਨਵੀਨਤਮ ਫਿਲਮਾਂ ਦਿਖਾਉਂਦੇ ਹਨ ਉਹਨਾਂ ਵਿੱਚੋਂ ਮੁੱਖ ਥੀਏਟਰ ਹਨ ਪ੍ਰਾਈਮ ਸਿਨੇਮਾ ਬਿਗ ਸਿਨੇਮਾ ਪੀ ਵੀ ਆਰ ਸਿਨੇਮਾ ਅਤੇ ਐੱਸ ਆਰ ਐੱਸ ਸਿਨੇਮਾ ਹਨ ਜੋ ਕਿ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਜਿਵੇਂ ਕਿ ਪਟਿਆਲਾ ਫਿਰੋਜ਼ਪੁਰ ਬਠਿੰਡਾ ਜਲੰਧਰ ਜ਼ੀਰਕਪੁਰ ਰਾਜਪੁਰਾ ਫਗਵਾੜਾ ਆਦਿ ਵਿੱਚ ਸਥਿਤ ਹਨ ਜਿਹਨਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਲਗਭਗ ਸੱਠ ਰੁਪਏ ਤੋਂ ਸ਼ੁਰੂ ਹੋ ਕੇ ਦੋ ਸੌ ਰੁਪਏ ਤੋਂ ਉੱਪਰ ਚਲੀਆਂ ਜਾਂਦੀਆਂ ਹਨ ਧੰਨਵਾਦ